ਹੈਲੋ ਹਾਂਜੀ ਮੈਮ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਹੋ ਅੱਛਾ ਅੱਛਾ ਕਿਰਨ ਨੇ ਨੰਬਰ ਦਿੱਤਾ ਅੱਛਾ ਅੱਛਾ ਤੁਸੀਂ ਆਏ ਹੋ ਅੱਛਾ ਅੱਛਾ ਕਹਿ ਰਹੇ ਸੀ ਕੱਲ੍ਹ ਕੀ ਕੋਈ ਆਇਆ ਹੈ ਨਵਾਂ ਪਰ ਇਹ ਨੀ ਪਤਾ ਕਿ ਕੌਣ ਆਇਆ ਹੈ ਹਾਂਜੀ ਡੇਰੀਆਂ ਤਾਂ ਇੱਥੇ ਦੋ ਤਿੰਨ ਨੇ ਜਿਸ ਤਰ੍ਹਾਂ ਭਿੰਡਰ ਡੇਅਰੀ ਹੋਵੇਗੀ ਕਾਲ਼ੋ ਨੂੰ ਡੇਅਰੀ ਹੋਗੀ ਆਮੂਲ ਵੀ ਹੈਗਾ ਵੇਰਕਾ ਵੀ ਹੈਗਾ ਹੈ ਪਰ ਸਾਰੇ ਜਿਦਾ ਆਪੋ ਆਪਣਾ ਰੇਟ ਦਈ ਜਾਂਦੇ ਹੈ ਜੇ ਘਰਾਂ 'ਚੋ ਲੋ ਅਤੇ ਉਹ ਵੀ ਠੀਕ ਹੈ ਪਰ ਘਰਾਂ ਵਾਲ਼ੇ ਮਿਲਾਵਟ ਬਹੁਤ ਕਰ ਰਹੇ ਨੇ ਡੇਅਰੀ ਵਾਲ਼ੇ ਵੀ ਠੀਕ ਨੇ ਅਤੇ ਜਿਸ ਤਰ੍ਹਾਂ ਡੇਅਰੀ ਵਿੱਚੋਂ ਤੁਸੀਂ ਕਿਦਾ ਕ ਮੱਝ ਦਾ ਲੈਣਾ ਕਿ ਗਾਂ ਦਾ ਦੁੱਧ ਲੈਣਾ ਚਾਹੁੰਦੇ ਹੋ ਮੱਝ ਦਾ ਦੁੱਧ ਘਰਾਂ ਵਿੱਚ ਅਤੇ ਇਦਾਂ ਲੋਕੀ ਕੋਈ ਕੁਝ ਕਹਿੰਦਾ ਕੋਈ ਕੁਝ ਕੋਈ ਪੈਂਠ ਕਹਿ ਅੰਡਿਆ ਕੋਈ ਸੱਠ ਕਹਿ ਅੰਡਿਆ ਪਰ ਡੇਅਰੀ ਵਿੱਚੋਂ ਦੁੱਧ ਤੇ ਮਿਲਦਾ ਹੈ ਪੰਜਾਹ ਸੱਠ ਰੁਪਏ ਪਰ ਦੁੱਧ ਵਧੀਆ ਮਿਲ ਜਾਂਦਾ ਜੇ ਅਤੇ ਕੋਈ ਨੀ ਜੇ ਤੁਹਾਨੂੰ ਕਿ ਹਾਂਜੀ ਹਾਂਜੀ ਵੇਰਕਾ ਤੋਂ ਸਭ ਕੁਝ ਦਹੀਂ ਲੱਸੀ ਵੀ ਮਿਲ ਜਾਂਦਾ ਹੈ ਕੋਈ ਨੀ ਜੇ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਲੋੜ ਹੈ ਅਤੇ ਮੈਂ ਤੁਹਾਡੇ ਨਾਲ਼ ਚੱਲਾਂਗੀ ਅਤੇ ਕੋਈ ਨੀ ਕਦੋਂ ਜਦੋਂ ਤੁਹਾਡੇ ਕੋਲ਼ ਟਾਈਮ ਹੋਏ ਤਾਂ ਤੁਸੀਂ ਦੱਸ ਦਿਓ ਹਾਂਜੀ ਹਾਂ ਹਾਂ ਕੋਈ ਨੀ ਮੈਂ ਚੱਲ ਪਵਾਂਗੀ ਜੇ ਤੁਹਾਨੂੰ ਹੁਣ ਵੀ ਕਿਸੇ ਚੀਜ਼ ਦੀ ਵੀ ਲੋੜ ਹੈ ਜੇ ਹੁਣ ਦੁੱਧ ਵੀ ਚਾਹੀਦਾ ਅਤੇ ਘਰ ਹੈਗਾ ਮੈਂ ਪਹੁੰਚਾ ਸਕਦੀ ਹਾਂ ਕੋਈ ਨੀ ਫੜਾ ਜਾ ਨਹੀਂ ਤਾਂ ਮੈਂ ਅੱਛਾ ਜੀ ਅੱਛਾ ਇਹਨਾਂ ਦਾ ਰੇਟ ਸੱਠ ਮਿਲ ਜਾਣਾ ਪੰਜਾਹ ਸੱਠ ਰੁਪਏ ਜੀ ਹਾਂਜੀ ਅਤੇ ਜੇ ਵਧੀਆ ਜਿਆਦਾ ਪਿਓਰ ਲੈਣਾ ਹੈ ਉਹ ਤਾਂ ਫਿਰ ਸੱਤਰ ਵੀ ਹੈ ਪੈਂਠ ਵੀ ਹੈ ਸੱਤਰ ਵੀ ਹੈ ਅਤੇ ਕੋਈ ਨੀ ਜਿਸ ਤਰ੍ਹਾਂ ਤੁਸੀਂ ਦੱਸ ਦਿਓ ਹਾਂਜੀ ਦਹੀਂ ਲੱਸੀ ਵੀ ਸੱਤਰ ਰੁਪਏ ਦਹੀਂ ਹੈ ਅਤੇ ਲੱਸੀ ਪੈਕਟਾਂ ਵਿੱਚ ਹੀ ਆਉਂਦੀ ਤੁਹਾਨੂੰ ਪਤਾ ਹੀ ਹੈ ਦਸ ਰੁਪਏ ਵਾਲਾ ਵੀ ਵੀਹ ਵਾਲਾ ਵੀ ਅਤੇ ਖੁੱਲ੍ਹੀ ਲੱਸੀ ਡੇਅਰੀ ਤੋਂ ਨੀ ਮਿਲਦੀ ਇੱਥੋਂ ਕਿਤੇ ਵੀ ਠੀਕ ਹੈ ਠੀਕ ਹੈ ਹੋਰ ਠੀਕ ਠਾਕ ਹਾਂਜੀ ਜਦੋਂ ਮਰਜ਼ੀ ਤੁਸੀਂ ਕਿਹੋ ਮੈਂ ਆ ਜਾਵਾਂਗੀ ਠੀਕ ਹੈ ਜੀ ਠੀਕ ਓਕੇ ਠੀਕ ਹੈ ਓਕੇ ਓਕੇ